ਪੰਜਾਬ ਵਿੱਚ ਆਈ ਟੀ ਵਿਭਾਗ ਨੈੱਟਵਰਕ ਨਾਲ ਸੰਬੰਧਿਤ ਹੈ ਆਈ ਟੀ ਵਿੱਚ ਕੰਪਿਊਟਰ ਸਮੱਸਿਆਵਾਂ ਦੇ ਨਿਪਟਾਰੇ ਵਿੱਚ ਕਰਮਚਾਰੀਆਂ ਦੀ ਮਦਦ ਕੀਤੀ ਜਾਂਦੀ ਹੈ ਆਈ ਟੀ ਦਾ ਲਕਸ਼ ਅਤੇ ਨੀਤੀਆਂ ਨਿਰਧਾਰਿਤ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਆਈ ਟੀ ਦੇ ਬਜਟ ਨੂੰ ਸਹੀ ਤਰੀਕੇ ਨਾਲ਼ ਪੇਸ਼ ਕਰਨ ਲਈ ਪੰਜਾਬ ਵਿੱਚ ਬਹੁਤ ਕਦਮ ਚੁੱਕੇ ਜਾ ਰਹੇ ਹਨ ਸੁਰਕਸ਼ਾ ਅਤੇ ਤਕਨੀਕੀ ਪ੍ਰਣਾਲੀਆਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਆਈ ਟੀ ਦੇ ਵਿਵਸਾਇਕ ਲਕਸ਼ ਦੇ ਨਾਲ ਮਿਲ ਕੇ ਅਧਿਕਾਰੀਆਂ ਦਾ ਅਧਿਕਾਰੀਆਂ ਦੀ ਮਦਦ ਕਰਨਾ ਪੰਜਾਬ ਸਰਕਾਰ ਦਾ ਵਿਸ਼ਾ ਬਣ ਚੁੱਕਿਆ ਹੈ ਪੰਜਾਬ ਸਰਕਾਰ ਕੰਪਨੀਆਂ ਦੇ ਡਾਟੇ ਨੂੰ ਸੁਰੱਖਿਅਤ ਅਤੇ ਬੈਕਅੱਪ ਕਰਨ ਦੇ ਲਈ ਬਹੁਤ ਕਦਮ ਚੁੱਕ ਰਹੀ ਹੈ ਹਾਰਡਵੇਅਰ ਅਤੇ ਸੋਫਟਵੇਅਰ ਦੀ ਨਿਗਰਾਨੀ ਲਈ ਬਹੁਤ ਕੰਮ ਕੀਤੇ ਜਾ ਰਹੇ ਹਨ